ਹੈਲੋ ਹਾਂ ਭਰਾ ਕਿਵੇਂ ਕੀ ਹਾਲ ਨੇ ਬ ਬਸ ਵਧੀਆ ਵਧੀਆ ਤੂੰ ਸੁਣਾ ਘਰ ਸਾਰੇ ਵਧੀਆ ਵਾਹ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਕੰਮ ਕਾਰ ਵਧੀਆ ਚੱਲਦਾ ਬਸ ਆਪਾਂ ਇਹੋ ਪੁੱਛਣਾ ਸੀ ਕਿ ਆਪਾਂ ਬੱਚੇ ਸਕੂਲੇ ਪਾਉਣੇ ਨੇ ਅਤੇ ਆਪਣੇ ਫਿਰੋਜ਼ਪੁਰ ਦੇ ਵਿੱਚ ਕਿਹੜਾ ਆਪਣਾ ਵਧੀਆ ਸਕੂਲ ਹੈਗਾ ਹੈ ਆਪਣਾ ਇੱਕ ਤਾਂ ਆਪਣਾ ਨਿਊ ਹੀ ਹੈ ਬੱਚਾ ਅਤੇ ਆਪਣਾ ਪਾਉਣਾ ਆਪਣਾ ਪਲੇਵੇ ਕਲਾਸ 'ਚ ਪਾਉਣਾ ਅਤੇ ਇੱਕ ਆਪਾਂ ਫਿਫਥ ਕਲਾਸ 'ਚ ਪਾਉਣਾ ਹਾਂਜੀ ਅਤੇ ਇੱਕ ਫਿਫਥ ਕਲਾਸ 'ਚ ਨਹੀਂ ਨਹੀਂ ਆਪਾਂ ਲੋਕਲ ਤਾਂ ਆਪਾਂ ਨੂੰ ਫਿਰੋਜ਼ਪੁਰ ਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਆਪਾਂ ਉਹਨਾਂ ਨੂੰ ਬਸ ਐਜੂਕੇਸ਼ਨ ਜਿੱਥੇ ਦੇ ਟੀਚਰ ਵਧੀਆ ਹੋਣ ਅਤੇ ਆਪਾਂ ਨੂੰ ਸਕੂਲ ਦੇ ਵਿੱਚ ਫੈਸਿਲਟੀਆਂ ਸਭ ਤੋਂ ਜ਼ਿਆਦਾ ਹੋਣ ਤਾਂ ਕਰਕੇ ਉੱਥੇ ਆਪਾਂ ਪਾ ਦੇਈਏ ਨਹੀਂ ਆਪਾਂ ਹਾਇਰ ਐਜੂਕੇਸ਼ਨ ਵਾਸਤੇ ਜੇ ਤਾਂ ਆਪਾਂ ਨੂੰ ਫਸਿਲਿਟੀ ਤਾਂ ਆਪਾਂ ਟੀਚਰ ਵੇਖਣੇ ਆ ਟੀਚਰਾਂ ਦੀ ਉੱਥੇ ਕੁਆਲੀਫਿਕੇਸ਼ਨ ਕੀ ਹੈ ਜਾਂ ਟੀਚਰ ਦੀ ਪੜ੍ਹਾਉਣ ਦਾ ਤਰੀਕਾ ਕੀ ਹੈ ਟੀਚਰ ਕਿਵੇਂ ਪੜ੍ਹਾਉਂਦੇ ਨੇ ਅਤੇ ਬਸ ਆਪਾਂ ਨੂੰ ਇਹ ਕੋਈ ਨਹੀਂ ਕਿ ਹਾਂ ਵੀ ਸਰਕਾਰੀ ਪਾਉਣਾ ਜਾਂ ਗੋਰਮੈਂਟ ਪਾਉਣਾ ਜਾਂ ਲੋਕਲ ਕਿਤੇ ਪਾਉਣਾ ਜਾਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਪਾਉਣਾ

ਅੱਛਾ ਜੀ ਅਤੇ

ਅੱਛਾ ਜੀ ਅੱਛਾ ਜੀ ਅੱਛਾ ਠੀਕ ਹੈ ਅੱਛਾ ਜੀ ਅੱਛਾ ਜੀ ਠੀਕ ਹੈ ਅਤੇ ਆਪਣਾ ਫੇਸ ਵਗੈਰਾ ਕੀ ਹੈ ਜੇ ਆਪਾਂ ਫਿਫਥ ਕਲਾਸ ਦੇ ਬੱਚੇ ਦੀ ਪੁੱਛੀਏ ਤਾਂ ਅੱਛਾ ਜੀ ਅੱਛਾ ਕੈਟਾਗਰੀ ਵਾਈਸ ਅੱਛਾ ਜੀ ਅਤੇ ਆਪਣਾ ਬੱਸ ਦਾ ਕਿਰਾਇਆ ਵਗੈਰਾ ਕੀ ਹੈ ਵੈਨ ਜਿਹੜੀ ਸਕੂਲ ਵੈਨ ਹੁੰਦੀ ਆਪਣਾ ਫਿਰੋਜ਼ਪੁਰ ਤੱਕ ਜਾਣ ਲਈ ਅੱਛਾ ਜੀ ਅੱਛਾ ਜੀ ਉਹਨਾਂ ਦੇ ਵਿੱਚ ਟੀਚਰ ਵੀ ਕੋ ਐਜੂਕੇਟਿਡ ਨੇ ਅੱਛਾ ਜੀ ਅੱਛਾ ਠੀਕ ਹੈ ਆਪਣਾ ਕੋਈ ਇੱਥੇ ਫਿਜੀਕਲ ਲੈਕਚਰ ਵੀ ਚਰਨ ਲੱਗਦਾ ਜੀ ਆਪਣਾ ਖੇਡਾਂ ਖੁਡਾਂ ਵਾਸਤੇ ਜਿਵੇਂ ਹੋ ਗਿਆ ਅੱਛਾ ਜੀ ਹਾਂ ਹਾਂ ਹਾਂ ਹਾਂ ਠੀਕ ਹੈ ਠੀਕ ਹੈ ਜਿਵੇਂ ਕਿ ਜਿਵੇਂ ਬੱ ਬੱਚਿਆਂ ਦੀਆਂ ਵੱਖਰੀਆਂ ਕੰਪਿਊਟਰ ਕਲਾਸਾਂ ਲੱਗਣੀਆਂ ਜਾਂ ਜਿਵੇਂ ਬੱਚਿਆਂ ਦੇ ਇੱਕ ਪੀਰਿਅਡ ਵੈਸੇ ਫਿਜੀਕਲ ਜਿਵੇਂ ਖੇਡਾਂ ਖੁਡਾਂ ਦਾ ਲੱਗਣਾ ਠੀਕ ਹੈ ਠੀਕ ਹੈ ਵੀਰੇ ਹੋਰ ਸੁਣਾਓ ਵਧੀਆ ਸਾਰੇ ਘਰ ਪਰਿਵਾਰ ਤੁਸੀਂ ਆਪਣੇ ਬੱਚੇ ਕਿੱਥੇ ਪਾਏ ਹੋਏ ਨੇ ਅੱਛਾ ਜੀ ਅੱਛਾ ਵਧੀਆ ਉਹਨਾਂ ਦੀ ਸਟਡੀ ਚੱਲ ਰਹੀ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਥੈਂਕ ਯੂ ਚਲੋ ਬਹੁਤ ਵਧੀਆ ਅੱਛਾ ਜੀ ਅੱਛਾ ਠੀਕ ਠੀਕ ਹੈ ਠੀਕ ਓਕੇ ਠੀਕ ਹੈ ਵੀਰੇ ਧੰਨਵਾਦ ਜੀ ਓਕੇ ਥੈਂਕ ਯੂ ਠੀਕ ਹੈ